ਪੰਜਾਬ ਵਿੱਚ ਕਈ ਐਸੇ ਕਾਰੋਬਾਰ ਹਨ ਜੋ ਕਿ ਅੰਤਰਰਾਸ਼ਟਰੀ ਸਤਰ ਤੱਕ ਛਾ ਗਏ ਹਨ ਮਿਸਾਲ ਲਈ ਹੀਰੋ ਸਾਈਕਲ ਦੁਨੀਆਂ ਦੀ ਸਭ ਤੋਂ ਵੱਡੀ ਸਾਈਕਲ ਬਣਾਉਣ ਵਾਲੀ ਕੰਪਨੀ ਹੈ ਅਤੇ ਇਹ ਪੰਜਾਬ ਵਿੱਚ ਹੀ ਸ਼ੁਰੂ ਹੋਈ ਸੀ ਇਸ ਤੋਂ ਇਲਾਵਾ ਟ੍ਰਾਇਡੈਂਟ ਗਰੁੱਪ ਹੈ ਜੋ ਕਿ ਟੈਕਸਟਾਈਲ ਔਰ ਕੈਮੀਕਲ ਦਾ ਇੱਕ ਬੜਾ ਕਾਰੋਬਾਰ ਹੈ ਉਹ ਵੀ ਅੰਤਰਰਾਸ਼ਟਰੀ ਸਤਰ ਅਤੇ ਮਸ਼ਹੂਰ ਹੈ ਪੰਜਾਬ ਦੀ ਐਗਰੀਕਲਚਰ ਵੀ ਬਾਹਰ ਦੇ ਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਜਿਵੇਂ ਚੌਲ ਅਤੇ ਫਲ ਫਰੂਟ ਸ਼ਾਮਿਲ ਹੈ ਮੇਰੇ ਅਨੁਸਾਰ ਪੰਜਾਬ ਦੇ ਕਾਰੋਬਾਰ ਅੰਤਰਰਾਸ਼ਟਰੀ ਸਤਰ 'ਤੇ ਪਹੁੰਚਣ ਲਈ ਕੁਝ ਤਰੱਕੀ ਨੇ ਪਹਿਲੇ ਕੁਆਲਿਟੀ 'ਤੇ ਆਉਂਦੇ ਨੇ ਬਹੁਤ ਜ਼ਰੂਰੀ ਹੈ ਦੂਜਾ ਮਾਰਕਟਿੰਗ ਔਰ ਬਰੈਂਡਿੰਗ 'ਤੇ ਵੀ ਫੋਕਸ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਤੁਹਾਡੇ ਪ੍ਰੋਡਕਟ ਬਾਰੇ ਜਾਣ ਸਕਣ ਤੀਸਰਾ ਟੈਕਨੋਲੋਜੀ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ ਤਾਂ ਕਿ ਤੁਸੀਂ ਆਪਣਾ ਪ੍ਰੋਡਕਸ਼ਨ ਪ੍ਰੋਸੈਸ ਬਿਹਤਰ ਬਣਾ ਸਕੋ ਆਖਿਰ ਵਿੱਚ ਇੰਟਰਨੈਸ਼ਨਲ ਟਰੇਡ ਫੇਅਰਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਤੁਸੀਂ ਆਪਣੇ ਪ੍ਰੋਡਕਟ ਨੂੰ ਦੁਨੀਆਂ ਭਰ ਦੇ ਲੋਕਾਂ ਤੱਕ ਪਹੁੰਚਾ ਸਕੋ